ਕਿਸੇ ਨੂੰ ਬਗੀਚਾ ਲਾਉਣਾ ਵਿੱਚ ਮਦਦ ਕਰਨਾ ਇੱਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਕਾਰਜ ਹੈ ਇਹ ਇੱਕ ਤਰ੍ਹਾਂ ਨਾਲ ਸਮਾਜਿਕ ਆਸ ਨੂੰ ਵਧਾਵਾ ਦਿੰਦਾ ਹੈ ਇੱਕ ਬਾਗ਼ ਜਾਂ ਬਗੀਚਾ ਲਾਉਣ ਵਿੱਚ ਮਦਦ ਕਰਨਾ ਪਰਿਵਾਰ ਅਤੇ ਦੋਸਤਾਂ ਸਮੇਤ ਮਾਨਸਿਕ ਸੁੱਖ ਅਤੇ ਖੁਸ਼ੀ ਪ੍ਰਦਾਨ ਕਰਦਾ ਹੈ ਇਸ ਕੰਮ ਵਿੱਚ ਮਦਦ ਦੇ ਨਾਲ ਨਾਲ ਅਸੀਂ ਨਵੇਂ ਸੁਝਾਅ ਅਤੇ ਵਿਚਾਰਾਂ ਦਾ ਅਦਾਨ ਪ੍ਰਦਾਨ ਵੀ ਕਰ ਸਕਦੇ ਹਾਂ ਕਿਸੇ ਨੂੰ ਬਗੀਚਾ ਲਾਉਣ ਵਿੱਚ ਮਦਦ ਕਰਨ ਵਿੱਚ ਉਸ ਸਬੰਧਿਤ ਵਿਅਕਤੀ ਦਾ ਧਿਆਨ ਰੱਖਣਾ ਅਤੇ ਉਸਨੂੰ ਮਾਨ ਉਸ ਦੇ ਅਭਿਆਸ ਸਖਸ਼ੀਅਤ ਨੂੰ ਧਿਆਨ ਵਿੱਚ ਰੱਖਣਾ ਬਹੁਤ ਮਹੱਤਵਪੂਰਨ ਹੈ ਜਿਵੇਂ ਹੀ ਉਹ ਇੱਕ ਅਨੁਭਵ ਕਰਦਾ ਹੈ ਕਿ ਕਿਹੜਾ ਪੌਦਾ ਕਿੱਥੇ ਲਾਉਣਾ ਹੈ ਅਤੇ ਉਸਨੂੰ ਕਿਵੇਂ ਪਾਲਣਾ ਹੈ ਤਾਂ ਵਿਅਕਤੀ ਮਾਨਸਿਕ ਤੌਰ 'ਤੇ ਤਿਆਰ ਹੋ ਜਾਂਦਾ ਹੈ ਵਿਅਕਤੀ ਨਾਲ ਵਿਚਾਰ ਕਰਕੇ ਪ੍ਰੋਜੈਕਟ ਬਾਰੇ ਸਮੇਂ ਸਮੇਂ ਗੱਲਬਾਤ ਕਰਕੇ ਉਹਨਾਂ ਦੇ ਉਤਸ਼ਾਹ ਨੂੰ ਹੋਰ ਵਧਾਇਆ ਜਾ ਸਕਦਾ ਹੈ ਇਸ ਤਰ੍ਹਾਂ ਬਗੀਚਾ ਲਾਉਣਾ ਇੱਕ ਕੰਮ ਦੇ ਪੂਰਾ ਕਰਨ ਦੇ ਬਰਾਬਰ ਨਹੀਂ ਸਗੋਂ ਆਪਣੇ ਨਵੇਂ ਸੁਝਾਅ ਅਤੇ ਵਿਚਾਰ ਪ੍ਰਗਟ ਕਰਨ ਦੇ ਇੱਕ ਅਕਸ ਅਵਸਰ ਵਾਂਗ ਹੈ ਬਗੀਚਾ ਲਾਉਣ ਲਈ ਸਭ ਤੋਂ ਪਹਿਲਾਂ ਜਮੀਨ ਦਾ ਵ ਪੱਧਰ ਵਧੀਆ ਹੋਣਾ ਚਾਹੀਦਾ ਹੈ ਮਿੱਟੀ ਦੀ ਕਿਸਮ ਬਗੀਚਾ ਲਾਉਣ ਵਿੱਚ ਬਹੁਤ ਮਹੱਤਵਪੂਰਨ ਬਹੁਤ ਮਹੱਤਵਪੂਰਨ ਹਿੱਸਾ ਹੈ ਉਸ ਤੋਂ ਬਾਅਦ ਮੌਸਮ ਦੇ ਅਨੁਸਾਰ ਛੋਟੇ ਪੌਦੇ ਲਗਾਏ ਜਾ ਸਕਦੇ ਹਨ ਅਗਰ ਘਰ ਦਾ ਵਿਹੜਾ ਬਹੁਤ ਵੱਡਾ ਹੈ ਤਾਂ ਘਰੇਲੂ ਪੌਦੇ ਜਿਵੇਂ ਕਿ ਅੰਬ ਅਨਾਰ ਜਾਮਣ ਨਿੰਬੂ ਨਿੰਮ ਵੀ ਲਗਾਏ ਜਾ ਸਕਦੇ ਹਨ ਇਸ ਤੋਂ ਇਲਾਵਾ ਅੱਜ ਕੱਲ੍ਹ ਬਹੁਤ ਪ੍ਰਕਾਰ ਦੇ ਸਜਾਵਟ ਵਾਲੇ ਪੌਦੇ ਵੀ ਨਰਸਰੀ ਵਿੱਚੋਂ ਮਿਲ ਜਾਂਦੇ ਹਨ ਜੋ ਕਿ ਗਮਲੇ ਵਿੱਚ ਵੀ ਲੱਗਦੇ ਹਨ ਜਮੀਨ ਵਿੱਚ ਵੀ ਲੱਗ ਜਾਂਦੇ ਹਨ ਇਹ ਸਾਡੀ ਜਗ੍ਹਾ 'ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੀ ਜਗ੍ਹਾ 'ਤੇ ਆਪਣਾ ਬਗੀਚਾ ਲਾਉਣਾ ਹੈ ਸਜਾਵਟ ਵਾਲੇ ਫੁੱਲਾਂ ਵਾਲੇ ਪੌਦਿਆਂ ਨੂੰ ਦੇਖ ਕੇ ਮਨ ਅਤੇ ਰੂਹ ਖਿੜ ਜਾਂਦੀ ਹੈ ਆਲਾ ਦੁਆਲਾ ਵੀ ਮਹਿਕਦਾ ਹੈ ਇਸ ਕਰਕੇ ਸਾਨੂੰ ਹਰੇਕ ਘਰ ਵਿੱਚ ਛੋਟਾ ਜਿਹਾ ਬਗੀਚਾ ਲਾਉਣਾ ਚਾਹੀਦਾ ਹੈ